ਪੱਚੀ ਮਾਰਚ ਉੱਨੀ ਸੌ ਉਣਹੱਤਰ ਉੱਨੀ ਸਤੰਬਰ ਉੱਨੀ ਸੌ ਚੁਰਾਨਵੇਂ ਚਾਰ ਸਤੰਬਰ ਉੱਨੀ ਸੌ ਛਿਆਨਵੇਂ ਇੱਕ ਮਈ ਉੱਨੀ ਸੌ ਨੜ੍ਹਿਨਵੇਂ ਦੋ ਅਗਸਤ ਦੋ ਹਜ਼ਾਰ ਇੱਕ